ਧਰਤੀ ਦੀ ਉੱਪਰੀ ਸਤਹ ਤੋਂ ਕੁਝ ਨੀਚੇ ਮਿੱਟੀ ਦੇ ਠੋਸ ਕਣਾਂ ਦੇ ਵਿੱਚ ਹਵਾ ਅਤੇ ਨਮੀ ਬਣੀ ਰਹਿੰਦੀ ਹੈ ਅਤੇ ਜਦੋਂ ਅਸੀਂ ਮਿੱਟੀ ਵਿੱਚ ਖੁਦਾਈ ਕਰਦੇ ਹਾਂ ਤਾਂ ਉਸ ਖੱਡੇ ਨੂੰ ਭਰਨ ਲਈ ਠੋਸ ਕਣਾਂ ਦੇ ਵਿੱਚੋਂ ਪਾਣੀ ਨਿਕਲਣ ਲੱਗਦਾ ਹੈ ਜਿਸ ਨੂੰ ਅਸੀਂ ਬਾਹਰ ਕੱਢਦੇ ਹਾਂ ਅਤੇ ਇਹ ਖੂਹ ਦਾ ਰੂਪ ਧਾਰਨ ਕਰਦਾ ਹੈ ਜ਼ਮੀਨ ਵਿੱਚ ਪਾਣੀ ਖਿੱਚਣ ਲਈ ਇੱਕ ਪਾਈਪ ਅਤੇ ਪੰਪ ਦੀ ਵਰਤੋਂ ਕਰ ਸਕਦੇ ਹਾਂ ਪੁਰਾਣੇ ਸਮਿਆਂ ਵਿੱਚ ਰੱਸੀਆਂ ਅਤੇ ਸਧਾਰਨ ਬਾਲਟੀਆਂ ਰਾਹੀਂ ਪਾਣੀ ਨੂੰ ਖਿੱਚਿਆ ਜਾਂਦਾ ਸੀ ਹੁਣ ਅਸੀਂ ਪਾਣੀ ਖਿੱਚਣ ਲਈ ਪੰਪ ਦੀ ਵਰਤੋਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਇਲੈਕਟ੍ਰੋਨਿਕ ਮੋਟਰ ਦੁਆਰਾ ਵੀ ਚਲਾਇਆ ਜਾ ਸਕਦਾ ਹੈ ਇਹ ਪੰਪ ਬਿਜਲੀ ਦੀ ਸਹਾਇਤਾ ਨਾਲ ਪਾਣੀ ਨੂੰ ਧਰਤੀ ਤੋਂ ਉੱਪਰ ਖਿੱਚਦੇ ਹਨ ਜਿਸ ਨਾਲ ਅਸੀਂ ਘੱਟ ਸਮੇਂ ਵਿੱਚ ਪਾਣੀ ਪ੍ਰਾਪਤ ਕਰ ਸਕਦੇ ਹਾਂ ਇਸ ਪਾਣੀ ਅਤੇ ਮੋਟਰ ਦੀ ਵਰਤੋਂ ਜ਼ਿਆਦਾਤਰ ਖੇਤਾਂ ਵਿੱਚ ਪਾਣੀ ਲਾਉਣ ਲਈ ਅਤੇ ਵੱਡੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ ਧੰਨਵਾਦ